ਭਾਰਤ ਦੇ ਵੱਖ ਅੱਡ ਅੱਡ ਹਿੱਸਿਆ ਦੇ ਵਿੱਚ ਅੱਜ ਕੱਲ੍ਹ ਪੰਜਾਬੀ ਵਟਾਂਦਰ ਅਤੇ ਸੱਭਿਆਚਾਰ ਦੇ ਵਿੱਚ ਪੰਜਾਬੀ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਆਪਾਂ ਆਮ ਹੀ ਦੇਖਦੇ ਹਾਂ ਕਿ ਅੱਜ ਕੱਲ੍ਹ ਜੋ ਵੀ ਹਿੰਦੀ ਫਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ ਬੋਲੀਵੁੱਡ ਦੇ ਵਿੱਚ ਉਹਨਾਂ ਵਿੱਚ ਆਮ ਤੌਰ 'ਤੇ ਪੰਜਾਬੀ ਅਦਾਕਾਰ ਹੁੰਦੇ ਨੇ ਅਤੇ ਗਾਣੇ ਵੀ ਅਕਸਰ ਪੰਜਾਬੀ ਭਾਸ਼ਾ ਦੇ ਵਿੱਚ ਹੀ ਗਾਏ ਜਾਂਦੇ ਆ ਅਤੇ ਇਹਦੇ ਕਰਕੇ ਹੁਣ ਆਪਾਂ ਇਹ ਵੀ ਦੇਖ ਸਕਦੇ ਹੈਗੇ ਹਾਂ ਕਿ ਪੰਜਾਬੀ ਹਰੇਕ ਭਾਰਤ ਦੇ ਹਰੇਕ ਰਾਜ ਦੇ ਵਿੱਚ ਵੱਸਦੇ ਆ ਅਤੇ ਜਿਹਦੇ ਕਰਕੇ ਉਹ ਜਿਹੜੇ ਵੀ ਪੰਜਾਬੀ ਤਿਉਹਾਰ ਨੇ ਉਹ ਹਰੇਕ ਥਾਂ ਮਨਾਏ ਜਾਂਦੇ ਆ ਅਤੇ ਜਿਹਦੇ ਕਰਕੇ ਜਿਹੜੇ ਹੋਰ ਸਟੇਟਾਂ ਦੇ ਲੋਕ ਨੇ ਉਹ ਵੀ ਪੰਜਾਬੀ ਵੱਲ ਆਕਰਸ਼ਿਤ ਹੁੰਦੇ ਨੇ ਅਤੇ ਉਹ ਸੱਭਿਆਚਾਰ ਦਾ ਹਿੱਸਾ ਬਣਦੇ ਨੇ ਅਤੇ ਉਹਦਾ ਆਨੰਦ ਮਾਣਦੇ ਨੇ ਆਪਾਂ ਹੁਣ ਆਮ ਹੀ ਦੇਖਦੇ ਹਨ ਇੰਟਰਨੈੱਟ 'ਤੇ ਬਹੁਤ ਸਾਰੇ ਲੋਕ ਹਨ ਜੋ ਪੰਜਾਬੀ ਭਾਸ਼ਾ ਨਾਲ ਜੁੜਦੇ ਜਾ ਰਹੇ ਹਨ ਅਤੇ ਉਹ ਪੰਜਾਬੀ ਤਿਉਹਾਰ ਮਨਾਉਂਦੇ ਹਨ ਅਤੇ ਪੰਜਾਬੀ ਦੇ ਵਿੱਚ ਗਾਣੇ ਗਾਉਂਦੇ ਹਨ ਅਤੇ ਇਸ ਤਰ੍ਹਾਂ ਪੰਜਾਬੀ ਅੱਜ ਕੱਲ੍ਹ ਪੂਰੇ ਭਾਰਤ ਦੇ ਵਿੱਚ ਇੱਕ ਸੰਚਾਰ ਅਤੇ ਸੱਭਿਆਚਾਰਕ ਵਟਾਂਦਰੇ ਵਿੱਚ ਇੱਕ ਬਹੁਤ ਜ਼ਰੂਰੀ ਭੂਮਿਕਾ ਨਿਭਾਅ ਰਹੀ ਆ